ਹੈਲੋ ਨਮਸਕਾਰ ਜੀ ਨਰੇਸ਼ ਕੁਮਾਰ ਬੋਲ ਰਿਹਾ ਜਗ੍ਹਾ ਹੈਗੀ ਆ ਲਰ ਇਰਿਸ਼ ਬੀਚ ਦਾ ਪਿਗ ਪੈਡਲਰਸ ਇੱਥੇ ਲੋਕ ਸੈਲਾਨੀ ਆਉਂਦੇ ਨੇ ਬਾਹਰੋਂ ਦੀ ਆਉਂਦੇ ਨੇ ਲੋਕਲ ਆਉਂਦੇ ਨੇ ਇੱਥੇ ਸੰਗੀਤ ਦਾ ਲੁਤਫ ਉਠਾਉਂਦੇ ਨੇ ਗਾਉਂਦੇ ਵੀ ਹੈ ਕੋਈ ਗਾ ਚੋਇਸ ਹੋਵੇ ਗਾਣਾ ਚਾਹ ਚਾਹਵੇ ਤਾਂ ਗਾ ਵੀ ਸਕਦਾ ਆ ਇੱਥੇ ਸੁਣ ਸੁਣ ਵੀ ਸਕਦਾ ਆ ਅਤੇ ਗਾ ਵੀ ਸਕਦਾ ਆ ਅਤੇ ਜੋ ਵੀ ਤੁਸੀਂ ਕਹੋਗੇ ਇਹ ਗੀਤ ਸੁਣਨਾ ਕਿ ਗਾਇਕ ਉਹੀ ਗੀਤ ਗਾਉਣਗੇ ਇੱਥੋਂ ਇੰਟਰਨੈਸ਼ਨਲ ਗਾਇਕ ਵੀ ਆਉਂਦੇ ਨੇ ਇੰਟਰਨੈਸ਼ਨਲ ਗਾਇਕ ਲੋਇ ਲੋਕਲ ਗਾਇਕ ਜਾਂ ਤੁਸੀਂ ਚਾਹੋ ਕਿ ਮੈਂ ਇੱਥੇ ਪਰੋਫੋਰਮੈਸ ਦੇਣਾ ਚਾਹੁੰਦਾ ਹਾਂ ਗਾਉਣਾ ਚਾਹੁੰਦਾ ਇਹ ਚੀਜ਼ ਤੁਸੀਂ ਵੀ ਉੱਥੇ ਜਾ ਕੇ ਇਹ ਚੀਜ਼ ਗਾ ਸਕਦੇ ਹੋ ਉਹਦਾ ਲੁਤਫ ਉਠਾ ਸਕਦੇ ਹੋ ਪੂਰਾ ਸੈਲਾਨੀ ਇੱਥੋਂ ਬਾਹਰੋਂ ਦੀ ਆਉਂਦੇ ਨੇ ਆ ਦੂਰੋਂ ਦੂਰੋਂ ਦੀ ਆ ਕੇ ਇੱਥੇ ਇੰਜੋਏ ਕਰਦੇ ਨੇ ਖਾਣ ਪੀਣ ਦਾ ਪੂਰਾ ਬੰਦੋਬਸਤ ਅੰਦਰ ਹੁੰਦਾ ਆ ਜੋ ਵੀ ਚੀਜ਼ ਤੁਸੀਂ ਖਮ ਖਾਣ ਨੂੰ ਮੰਗਵਾਉਣਾ ਚਾਹੋ ਮੰਗਵਾ ਸਕਦੇ ਹੋ ਸੁਣਨਾ ਚਾਹੋ ਸੁਣ ਸਕਦੇ ਹੋ ਪੂਰਾ ਇੰਜੋਏ ਫੀਲ ਕਰ ਸਕਦੇ ਹੋ ਤੁਸੀਂ ਇੱਥੇ ਬਹੁਤ ਵਧੀਆ ਮਜ਼ਾ ਆਏਗਾ ਤੁਹਾਨੂੰ ਓਕੇ